ਜਿਉਂ ਜਿਉਂ ਆਵਾਜਾਈ ਵੱਧ ਰਹੀ ਹੈ ਉਸ ਆਵਾਜਾਈ ਦੌਰਾਨ ਜੋ ਪੋਲਿਊਸ਼ਨ ਵੱਧ ਰਹੀ ਹੈ ਓਹ ਬਹੁਤ ਹੀ ਹਾਨੀਕਾਰਕ ਹੈ ਆਮ ਵਿਅਕਤੀ ਲਈ ਅਤੇ ਜਾਨਵਰਾਂ ਲਈ ਵੀ ਅਤੇ ਉਸ ਉਸ ਪਲ ਪ੍ਰਦੂਸ਼ਣ ਨੂੰ ਘਟਾਉਣ ਲਈ ਸਰਕਾਰ ਨੂੰ ਥਾਂ ਥਾਂ ਪੇੜ ਲਗਾਏ ਜਾਣੇ ਚਾਹੀਦੇ ਹਨ ਸਫਾਈ ਅਭਿਆਨ ਚਲਾਇਆ ਜਾਣਾ ਚਾਹੀਦਾ ਹੈ ਅਤੇ ਇਹ ਚੀਜ਼ਾਂ ਸਰਕਾਰ ਕਰ ਰਹੀ ਹੈ ਬਟ ਕੁਛ ਹੀ ਲਿਮਿਟਡ ਤੌਰ 'ਤੇ ਇਹ ਚੀਜ਼ਾਂ ਵਰਤੋਂ ਵਿੱਚ ਹਨ ਅਗਰ ਇਹ ਵਰਤੋਂ ਜ਼ਿਆਦਾ ਹੋ ਜਾਣ ਲੱਗ ਤੁਸੀਂ ਜਿੱਦਾਂ ਕਿ ਕਿ ਹਰ ਵਿਅਕਤੀ ਹਰ ਪੇ ਹਰ ਵਿਅਕਤੀ ਹਰ ਸਾਲ ਇੱਕ ਪੇੜ ਅਗਰ ਲਾਉਣਾ ਸ਼ੁਰੂ ਕਰ ਦੇਵੇ ਅਤੇ ਇਹ ਚੀਜ਼ਾਂ ਵੀ ਵਧਣਗੀ ਜਿੱਦਾਂ ਜਿੱਦਾਂ ਪੋਲਿਊਸ਼ਨ ਵੱਧ ਰਹੀ ਹੈ ਜਿੱਦਾਂ ਜਿੱਦਾਂ ਇੰਡਸਟਰੀਜ਼ ਆ ਰਹੀਆਂ ਹਨ ਉਸ ਦੌਰਾਨ ਕਿ ਪੇੜ ਕੱਟੇ ਜਾ ਰਹੇ ਹਨ ਪੇੜ ਕੱਟੇ ਜਾਣ ਨਾਲ ਉਹ ਥਾਂ ਕੱਟ ਕੇ ਇੰਡਸਟਰੀਜ਼ ਨੂੰ ਦੇਈ ਜਾ ਰਹੀ ਹੈ ਜਿਸ ਕਰਕੇ ਵੀ ਪੋਲਿਊਸ਼ਨ ਵੱਧ ਰਹੀ ਹੈ ਤਾਂ ਮੇਰੀ ਸਰਕਾਰ ਨੂੰ ਇਹ ਬੇਨਤੀ ਹੋਵੇਗੀ ਕਿ ਪੇੜ ਕੱਟਣ ਬਜਾਏ ਜੋ ਬੰਜਰ ਜਗ੍ਹਾ ਹੈ ਉੱਥੇ ਹੀ ਇੰਡਸਟਰੀ ਲਿਆਈ ਜਾਵੇ